ਸਤਿ ਸ਼੍ਰੀ ਅਕਾਲ ਕੌਣ ਸਾਹਿਲ ਸਾਹਿਲ ਕਿਮੇਂ ਐ ਧੰਨਵਾਦ ਧੰਨਵਾਦ ਹਾਂ ਕੋਈ ਨਾ ਮੈਨੂੰ ਪਤਾ ਲੱਗਿਆ ਤੂੰ ਕਿਤੇ ਐਮਰਜੈਂਸੀ ਕੰਮ ਚ ਜਾਣਾ ਸੀਗਾ ਹੋਰ ਕਿਮੇਂ ਚੱਲ ਰਿਹਾ ਅੱਜ ਕੱਲ੍ਹ ਕੰਮ ਭਰਾਵਾ ਅੱਜ ਕੱਲ੍ਹ ਅੱਜ ਕੱਲ੍ਹ ਕੰਪਿਊਟਰ ਨੇ ਬੰਦਿਆਂ ਦਾ ਕੰਮ ਅਸਾਨ ਕੀਤਾ ਇਆ ਸਾਡੇ ਟਾਈਮ ਤਾਂ ਚਾਰ ਦਿਨਾਂ ਦਾ ਕੰਮ ਹੁੰਦਾ ਸੀਗਾ ਮਸਾਂ ਅਸੀਂ ਥੱਕੇ ਹਾਰੇ ਹੁੰਦੇ ਸੀਗੇ ਪਰ ਅੱਜ ਕੱਲ੍ਹ ਚਾਰ ਘੰਟਿਆਂ ਚ ਕਰ ਦਿੰਦਾ ਕੰਪਿਊਟਰ ਹੂੰ

ਪਰ ਪਰ ਕੰਪਿਊਟਰ ਨੇ ਕੰਮ ਤਾਂ ਅਸਾਨ ਕੀਤਾ ਇਆ ਜਿੱਥੇ ਜਿਹੜੀਆਂ ਜਰੂਰੀਆਂ ਚੀਜਾਂ ਤੁਸੀਂ ਜਿਵੇਂ ਜਿਵੇਂ ਜਰੂਰੀ ਡੋਕੂਮੈਂਟ ਰੱਖਣੇ ਹੁੰਦੇ ਨੇ ਉਹ ਤੁਸੀਂ ਕੰਪਿਊਟਰ 'ਚ ਸੇਵ ਕਰ ਲੈਨੇ ਐ ਸਾਨੂੰ ਤਾਂ ਲੱਭਣੇ ਪੈਂਦੇ ਹੁੰਦੇ ਸੀਗੇ ਕਿੱਥੇ ਗਏ

ਕੋਈ ਨਾ ਕਰਾਂਗੇ ਹਲੇ ਥੋੜੇ ਅਗਲੇ ਹਫ਼ਤੇ ਕਰਦੇ ਆਂ ਕਿਉਂਕੀ ਫੇਰ ਥੋੜਾ ਅਰਾਮ ਕਰਨ ਨੂੰ ਵੀ ਹੁਣ ਉਮਰ ਬਹੁਤ ਹੋਗੀ ਐ ਨਾ ਕੀ ਕਰੀਏ

ਕੋਈ ਨਾ ਤੁਸੀਂ ਵੀ ਕਿਸੇ ਤੁਸੀਂ ਵੀ ਅੱਗੇ ਜਾ ਕੇ ਕਿਸੇ ਦੀ ਇੰਸਪੀਰੇਸ਼ਨ ਬਣੋਂਗੇ ਕੋਈ ਨਾ ਪਰ ਅੱਜ ਕੱਲ੍ਹ ਦੇ ਅੱਜ ਕੱਲ੍ਹ ਦੇ ਟਾਈਮ ਨੇ ਇਹ ਦਿਖਾ ਦਿੱਤਾ ਕੀ ਤੁਸੀਂ ਇੰਟਰ ਨਾ ਇੰਟਰਨੈੱਟ ਨਾ ਕੰਪਿਊਟਰ ਦੇ ਬਿਨ੍ਹਾਂ ਕੁਛ ਨੀ ਹੈਗੇ ਜਿੱਥੇ ਕੰਪਿਊਟਰ ਗਿਆ ਉੱਥੇ ਤੁਸੀਂ ਗਏ

ਹੋਰ ਸਭ ਵਧੀਆ ਹੋਰ ਤੂੰ ਸਣਾ ਕੁਛ ਆਪਣੇ ਬਾਰੇ ਠੀਕ ਐ ਨਾਲੇ ਅਗਲੇ ਹਫ਼ਤੇ ਆਈਂ ਇਹ ਨੀ ਕੀ ਹਾਂ ਐਮਰਜੈਂਸੀ ਬੋਲ ਕੇ ਭੱਜ ਜਵੇ ਹਾਂ ਚੱਲ ਠੀਕ ਐ